ਹੈਲੋ ਤੁਸੀਂ ਕਰਨ ਸਵੀਟ ਤੋਂ ਬੋਲ ਰਹੇ ਹੋ ਹਾਂਜੀ ਵੀਰ ਜੀ ਮੈਂ ਗੋਲਡਨ ਐਵਨਿਊ ਤੋਂ ਬੋਲ ਰਹੀ ਹਾਂ ਮੈਨੂੰ ਕੱਲ੍ਹ ਲੋਹੜੀ ਦੇ ਮੌਕੇ 'ਤੇ ਸਾਡੇ ਘਰ ਇੱਕ ਨਾ ਫੰਕਸ਼ਨ ਆ ਅਤੇ ਸਾਨੂੰ ਇੱਕ ਹਜ਼ਾਰ ਦੇ ਕਰੀਬ ਮੋਠਾਂ ਵਾਲੇ ਲੱਡੂ ਚਾਹੀਦੇ ਨੇ ਦਸ ਕੁ ਕਿਲੋ ਸਾਨੂੰ ਖੋਏ ਵਾਲੀ ਬਰਫੀ ਚਾਹੀਦੀ ਹੈ ਦਸ ਕੁ ਕਿਲੋ ਮੋਤੀਚੂਰ ਦੇ ਲੱਡੂ ਚਾਹੀਦੇ ਨੇ ਕੀ ਤੁਹਾਡੇ ਕੋਲ ਉਪਲਬਧ ਹੋਣਗੇ ਜੇਕਰ ਉਪਲਬਧ ਹੋਣਗੇ ਤਾਂ ਤੁਸੀਂ ਮੈ ਸਾਨੂੰ ਸ ਸਾਡੇ ਦੱਸੇ ਹੋਏ ਅਡਰੈੱਸ 'ਤੇ ਪਹੁੰਚਾ ਦਿਓ ਅਸੀਂ ਤੁਹਾਨੂੰ ਉਹਦੀ ਪੇਮੈਂਟ ਕੈਸ਼ ਔਨ ਡਿਲੀਵਰੀ ਕਰ ਦੇਵਾਂਗੇ ਤੁਸੀਂ ਮੈਨੂੰ ਉਹਨਾਂ ਦਾ ਰੇਟ ਦੱਸ ਦਿਉ ਅਤੇ ਕਿਰਪਾ ਕਰਕੇ ਸਾਫ ਸੁਥਰੀ ਅਤੇ ਸਵਾਦਿਸ਼ਟ ਹਿਸਾਬ ਦੇ ਨਾਲ ਅਤੇ ਸ਼ੁੱਧ ਸਮਾਨ ਦੇ ਨਾਲ ਤਿਆਰੀ ਕਰਿਓ ਸਮਾਨ ਦੀ ਤਾਂ ਕਿ ਪ੍ਰਸੰਨਤਾ ਹੋਵੇ ਤੁਹਾਡੀ ਭੇਜੀ ਹੋਈਆਂ ਡਿਸ਼ਿਜ਼ ਦੀਆਂ ਅਤੇ ਮੇਰਾ ਐਡਰੈੱਸ ਹੈਗਾ ਹੈ ਤਰਨ ਤਾਰਨ ਬੋੜੀ ਚੌਕ ਤਰਨ ਤਾਰਨ ਬੋੜੀ ਚੌਕ ਗੋਲਡਨ ਐਵਨਿਊ ਦੇ ਲਾਗੇ ਅਤੇ ਹਾਂਜੀ ਵੀਰ ਜੀ ਤੁਸੀਂ ਇੱਕ ਵਾਰੀ ਕੋਲ ਕਰ ਲਿਓ ਅਤੇ ਇਸ ਨੰਬਰ 'ਤੇ ਅਤੇ ਅਸੀਂ ਤੁਹਾਨੂੰ ਫਿਰ ਕੈਸ਼ ਔਨ ਡਿਲੀਵਰੀ ਪੇਮੈਂਟ ਜਿਹੜੀ ਨਾ ਉਹ ਕਰ ਦੇਵਾਂਗੇ ਠੀਕ ਹੈ ਵੀਰ ਜੀ ਧੰਨਵਾਦ